ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਓਵੇਰ ਤੋਂ ਬੋਲਦੇ ਓਂ ਜੀ ਅਸੀਂ ਤੁਹਾਡੀ ਓਵੇਰ ਬੁੱਕ ਕੀਤੀ ਸੀਗੀ ਜੀ ਆਪਣੇ ਮਹਾਲੀ ਨੂੰ ਬੇਟੇ ਨੂੰ ਰਿਸੀਵ ਕਰਨੇ ਲਈ ਜਾਣਾ ਸੀ ਤੁਸੀਂ ਕਿੱਥੇ ਕ ਆ ਗਏ ਓਂ ਅਤੇ ਕਦੋਂ ਕੁ ਤੱਕ ਸਾਡੇ ਕੋਲ ਪਹੁੰਚ ਸਕਦੇ ਓਂ ਕਿੰਨਾ ਕੁ ਸਮਾਂ ਲੱਗਣਾ ਤਾਂ ਕਿ ਅਸੀਂ ਉੱਥੇ ਸਮੇਂ ਸਿਰ ਪਹੁੰਚ ਜਾਈਏ ਤਾਂ ਕਿ ਬੇਟੇ ਨੂੰ ਕੋਈ ਰਸਤਾ ਪੁੱਛਣ ਯਾ ਇਧਰ ਉਧਰ ਜਾਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਅਤੇ ਇਸ ਕਰਕੇ ਤੁਸੀਂ ਆਪਣਾ ਸਾਨੂੰ ਪੂਰਾ ਬਾਇਓਡਾਟਾ ਦੱਸ ਕੇ ਵੀ ਕਿੰਨਾ ਕੁ ਸਮਾਂ ਲੱਗਣਾ ਕਦੋਂ ਤੱਕ ਅਸੀਂ ਜਾ ਸਕੀਏ ਅਤੇ ਧੰਨਵਾਦ ਜੀ